ਪੰਜਾਬ ਦੇ ਕਾਰੋਬਾਰ 'ਤੇ ਪ੍ਰਵਾਸੀਆਂ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਪਿਆ ਹੈ ਸਾਨੂੰ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ ਪ੍ਰਵਾਸੀ ਲੋਕ ਇੱਧਰ ਆ ਕੇ ਪੰਜਾਬ ਦੇ ਸਾਰੇ ਕੰਮ ਜਿਵੇਂ ਕਿ ਲੇਬਰ ਦਾ ਕੰਮ ਹੋ ਗਿਆ ਰੇਹੜੀ ਦਾ ਕੰਮ ਹੋ ਗਿਆ ਮਿਸਤਰੀ ਪੁਣੇ ਦਾ ਕੰਮ ਹੋ ਗਿਆ ਸਾਰਾ ਕਰਦੇ ਹਨ ਇਸ ਦੇ ਨਾਲ ਕੀ ਹੁੰਦਾ ਹੈ ਇਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਮੌਕਾ ਘੱਟ ਮਿਲਦਾ ਹੈ ਕੰਮ ਕਰਨ ਦਾ ਸਾਨੂੰ ਇਸ ਵੱਲ ਧਿਆਨ ਦੇਣਾ ਪਵੇਗਾ ਅਤੇ ਸਰਕਾਰਾਂ ਨੂੰ ਵੀ ਇਸ ਵੱਲ ਵਿਸ਼ੇਸ਼ ਧਿਆਨ ਦੇ ਦੇਣਾ ਪਵੇਗਾ ਤਾਂ ਜੋ ਪ੍ਰਵਾਸੀ ਇੱਧਰ ਆ ਕੇ ਕੰਮ ਨਾ ਕਰਨ ਪ੍ਰਵਾਸੀਆਂ ਦੇ ਕੰਮ ਕਰਨ ਨਾਲ ਪੰਜਾਬ ਦਾ ਸਾਰਾ ਪੈਸਾ ਹੋਰ ਸਟੇਟਾਂ ਨੂੰ ਜਾ ਰਿਹਾ ਹੈ ਸਭ ਤੋਂ ਪਹਿਲਾਂ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਇਸ ਨਾਲ ਨਜਿੱਠਣ ਲਈ ਸਭ ਤੋਂ ਪਹਿਲਾਂ ਸਾਨੂੰ ਜੋ ਪ੍ਰਵਾਸੀ ਇੱਧਰ ਆ ਕੇ ਆਪਣਾ ਰਿਹਾਇਸ਼ ਦਾ ਸਰਟੀਫਿਕੇਟ ਬਣਾਉਂਦੇ ਹਨ ਉਸ ਨੂੰ ਬੰਦ ਕਰਨਾ ਪਵੇਗਾ ਤਾਂ ਜੋ ਉਹ ਇੱਧਰਲੇ ਪੱਕੇ ਵਸਨੀਕ ਨਾ ਬਣ ਸਕਣ ਅਤੇ ਦੂਜਾ ਪੰਜਾਬੀ ਲੋਕਾਂ ਨੂੰ ਇਸ ਦੇ ਵਿਰੁੱਧ ਆਵਾਜ਼ ਉਠਾਉਣੀ ਪਵੇਗੀ ਅਤੇ ਇਹਨਾਂ ਦਾ ਵਿਰੋਧ ਕਰਨਾ ਪਵੇਗਾ ਤਾਂ ਜੋ ਪੰਜਾਬੀ ਅੱਗੇ ਵੱਧ ਸਕਣ ਇਨ ਇਹਨੂੰ ਰੋਕਣ ਲਈ ਸਾਨੂੰ ਹਰ ਸੰਭਵ ਕਦਮ ਕ ਉਠਾਉਣਾ ਚਾਹੀਦਾ ਹੈ